ਪੰਜਾਬ ਵਿੱਚ ਟੈਕਨੋਲਜੀ ਦਾ ਸੈਂਟਰ ਥਾਂ ਥਾਂ ਉੱਭਰ ਰਿਹਾ ਏ ਕਈ ਤਰਾਂ ਕਈ ਜਗ੍ਹਾ 'ਤੇ ਪੰਜਾਬ ਤਰੱਕੀਆਂ ਕਰ ਰਿਹਾ ਏ ਜਿਵੇਂ ਕਿ ਪੰ ਫੈਕਟਰੀ 'ਚ ਅੱਜ ਕੱਲ੍ਹ ਬਹੁਤ ਜ਼ਿਆਦਾ ਤਕਨੀਕੀਆਂ ਹੋ ਗਈਆਂ ਹਨ ਅਤੇ ਪਹਿਲੇ ਲੋਕ ਇੱਕ ਦੂਜੇ ਲਈ ਆਦਮੀ ਨੂੰ ਕੰਮ ਕਹਿੰਦੇ ਸੀ ਤਾਂ ਹੁਣ ਕਈ ਤਰੱਕੀਆਂ ਕਰਕੇ ਮਸ਼ੀਨਾਂ ਲਾਈਆਂ ਗਈਆਂ ਹਨ ਅਤੇ ਕਈ ਤਰ੍ਹਾਂ ਦੇ ਪਰਫੈਕਟ ਪੁਰਜੇ ਆ ਗਏ ਹਨ ਟੈਕਨੋਲੋਜੀ ਦਾ ਪੰਜਾਬ ਵਿੱਚ ਬਹੁਤ ਜ਼ਿਆਦਾ ਵਧੀਆ ਤਰੱਕੀਆਂ ਹੋ ਗਈਆਂ ਹਨ ਜਿਵੇਂ ਕਿ ਇੰਟਰਨੈਟ ਦਾ ਜ਼ਮਾਨਾ ਬਹੁਤ ਹੋ ਗਿਆ ਏ ਨਕਲੀ ਬੁੱਧੀ ਵੀ ਇੱਕ ਦੂਜੇ ਦੀ ਨਕਲ ਕਰਕੇ ਜ਼ਮਾਨਾ ਬਹੁਤ ਜ਼ਿਆਦਾ ਅੱਗੇ ਵੱਧ ਗਿਆ ਇਹ ਹੋ ਰਿਹਾ ਹੈ ਫਾਈਵ ਜੀ ਦਾ ਹੋ ਰਿਹਾ ਜ਼ਮਾਨਾ ਅਤੇ ਅੱਜ ਕੱਲ੍ਹ ਆਟੋਮੈਟਿਕ ਮਸ਼ੀਨਾਂ ਦਾ ਬਹੁਤ ਵਰਤੋਂ ਕੀਤੀ ਗਈ ਹੈ ਆਟੋਮੈਟਿਕ ਮਸ਼ੀਨਾਂ ਵੀ ਵਰਤੋਂ ਪਹਿਲੇ ਤਾਂ ਲੋਕੀ ਹੱਥਾਂ ਨਾਲ ਮਿਹਨਤਾਂ ਕਰਕੇ ਕੰਮ ਕਰਦੇ ਸੀ ਹੁਣ ਕਈ ਤਰ੍ਹਾਂ ਦੀਆਂ ਆਟੋਮੈਟਿਕ ਮਸ਼ੀਨਾਂ ਪੁਰਜੇ ਹਰ ਤਰ੍ਹਾਂ ਦੀ ਸਹੂਲਤਾਂ ਹੋ ਗਈ ਹੈ ਅਤੇ ਇੰਟਰਨੈਟ ਦਾ ਜ਼ਮਾਨਾ ਤਾਂ ਬਹੁਤ ਜ਼ਿਆਦਾ ਏ ਹਰ ਘਰ 'ਚ ਵਾਈਫਾਈ ਲੱਗਾ ਹੋਇਆ ਹੈ ਜਿਨਦੇ ਨਾਲ ਲੋਕਾਂ ਨੂੰ ਇੰਟਰਨੈਟ ਤੋਂ ਬਹੁਤ ਜ਼ਿਆਦਾ ਸੁਵਿਧਾ ਬਾਹਰ ਬੈਠੇ ਸ ਵਿਦੇਸ਼ਾਂ ਨੂੰ ਵੀ ਅਤੇ ਪੰਜਾਬ ਦੇ ਵਿਦੇ ਬਿਨਾਂ ਇੰਟਰਨੈੱਟ ਦੇ ਸਹਾਰੇ ਗੱਲ ਕਰ ਸਕਦੇ ਹਾਂ ਲੋਕਾਂ ਨੇ ਰੋਬਿਟ ਘਰਾਂ ਵਿੱਚ ਵੀ ਰੱਖਿਆ ਹੈ ਰੋਬਟ ਕਈ ਤਰ੍ਹਾਂ ਦੇ ਇਨਸਾਨੀ ਕੰਮ ਕਰ ਸਕਦਾ ਹੈ ਜਿਵੇਂ ਕਿ ਝਾੜੂ ਪੋਚਾ ਅਤੇ ਵਾਸ਼ਿੰਗ ਵੋ ਬਰਤਨ ਵੋਸ਼ ਗੈਰਾ ਵਗੈਰਾ ਕਈ ਫੈਕਟਰੀਆਂ 'ਚ ਵੀ ਰੋਬੋਟ ਏ ਕਈ ਤਰ੍ਹਾਂ ਤਰੱਕੀਆਂ ਹੋ ਰਹੀਆਂ ਹਨ ਪੰਜਾਬ ਪਹਿਲੇ ਤਰ੍ਹਾਂ ਨਹੀਂ ਰਿਹਾ ਉਹਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ ਅਤੇ ਥ੍ਰੀ ਡੀ ਪ੍ਰਿੰਟਿੰਗ ਦਾ ਵੀ ਬਹੁਤ ਫਾਇਦਾ ਏ ਅਤੇ ਬੱਚੇ ਵੀ ਕਰ ਇੰਟਰਨੈਟ ਦਾ ਬਹੁਤ ਜ਼ਿਆਦਾ ਉਪਯੋਗ ਕਰ ਰਹੇ ਹਨ ਬੱਚਿਆਂ ਦੇ ਵੀ ਅੱਜ ਕੱਲ੍ਹ ਬਹੁਤ ਜ਼ਿਆਦਾ ਸੁਵਿਧਾ ਵੱਧ ਗਈ ਹੈ ਅਤੇ ਬੈਂਕਿੰਗ ਵਿਚ ਏਟੀਐਮ ਦਾ ਏਟੀਐਮ ਰਾਹੀਂ ਅਸੀਂ ਬਹੁਤ ਜ਼ਿਆਦਾ ਤਰੱਕੀ ਕਰ ਲਈ ਪੰਜਾਬ ਨੇ ਅਤੇ ਅਤੇ ਅੱਜ ਕੱਲ੍ਹ ਪੰਜਾਬ ਤੈਕਨੋਲਜੀ ਸੈਂਟਰ ਬਹੁਤ ਹੀ ਵੱਧ ਰਹੇ ਹਨ ਅਤੇ ਪੰਜਾਬ ਅੱਗੇ ਨਾਲੋਂ ਗਰੀਬ ਨਹੀਂ ਰਿਹਾ ਬਹੁਤ ਜ਼ਿਆਦਾ ਅਮੀਰ ਹੋ ਗਿਆ ਹੈ ਅਤੇ ਤੱਕ ਤਰੱਕੀਆਂ ਨਾਲ ਵੱਧ ਰਿਹਾ ਏ